ਹੈਲੋ ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਜੀ ਕਿਆ ਹਾਲ ਚਾਲ ਹੈ ਵਧੀਆ ਜੀ ਵਧੀਆ ਹੋਰ ਜੀ ਕਿਆ ਕਰਦੇ ਹਾਂਜੀ ਹਾਂਜੀ ਭਾਅ ਜੀ ਅੱਛਾ ਜੀ ਹਾਂਜੀ ਹਾਂਜੀ ਭਾਅ ਜੀ ਜ਼ਰੂਰ ਜੀ ਗੋਭੀ ਤਾਂ ਭਾਅ ਜੀ ਇਹ ਆਪਣੀ ਔਰਗੈਨਿਕ ਹੈਗੀ ਹੈ ਜੀ ਅਤੇ ਪੰਜਾਹ ਰੁਪਏ ਕਿਲੋ ਚੱਲਿਆ ਕਰਦੀ ਹੈਗੀ ਜੀ ਹੁਣ ਤਾਂ ਹਾਂਜੀ ਆਪਾਂ ਨੂੰ ਭਾਅ ਜੀ ਤੁਸੀਂ ਲੈਣੀ ਕਿੰਨੀ ਕਰ ਹੈ ਜੀ ਭਾਅ ਜੀ ਆਪਾਂ ਫਿਰ ਤੁਹਾਡੇ ਵਾਸਤੇ ਚਾਲੀ ਰੁਪਏ ਲਾ ਦੇਵਾਂਗੇ ਜੀ ਦਸ ਰੁਪਏ ਲੈੱਸ ਕਰ ਦੇਵਾਂਗੇ

ਸ਼ਿਮਲਾ ਮਿਰਚ ਜੀ ਠੀਕ ਹੈ ਠੀਕ ਹੈ ਭਾਅ ਜੀ ਉਹ ਵੀ ਤੁਹਾਨੂੰ ਸੇਮ ਰੇਟ 'ਤੇ ਹੀ ਲੱਗ ਜਾਉਂਗੀ ਜੀ ਕੋਈ ਗੱਲ ਨਹੀਂ ਭਾਅ ਜੀ ਵਿਆਹ ਵਾਸਤੇ ਵਿਆਹ ਵਾਸਤੇ ਭਾਅ ਜੀ ਜ਼ਿਆਦਾ ਹੀ ਚਾਹੀਦੀ ਹੁੰਦੀ ਹੈ ਠੀਕ ਹੈ ਜੀ ਠੀਕ ਹੈ ਸਲਾਦ ਵਾਸਤੇ ਭਾਅ ਜੀ ਸਾਡੇ ਕੋਲ ਜਿਦਾਂ ਮੂਲੀਆਂ ਵਗੈਰਾ ਹੁੰਦੀਆਂ ਔਰਗੈਨਿਕ ਵਧੀਆ ਜੀ ਉਹ ਤੋਂ ਬਾਅਦ ਗਾਜਰਾਂ ਵੀ ਹੁੰਦੀਆਂ ਜੀ ਹਾਂਜੀ ਗਾਜਰਾਂ ਤੋਂ ਬਾਅਦ ਖੀਰੇ ਵੀ ਹੁੰਦੇ ਹੈ ਜੀ ਤਿੰਨੋਂ ਚੀਜ਼ਾਂ ਹੁੰਦੀਆਂ ਜੀ ਸਾਡੇ ਕੋਲ ਹਾਂਜੀ ਚੁਕੰਦਰ ਹੁੰਦੀ ਹੈ ਭਾਅ ਜੀ ਉਹ ਪਰ ਹੁਣ ਘੱਟ ਹੀ ਉਗਾਉਂਦੇ ਹਾਂ ਉਹਨੂੰ ਹੁਣ ਹਾਂਜੀ ਹਾਂਜੀ ਮੂਲੀ ਭਾਅ ਜੀ ਆਪਾਂ ਵੀਹ ਰੁਪਏ ਦਿੰਦੇ ਹੈਗੇ ਹੈ ਜੀ ਹੈ ਕਿਲੋਂ ਖੀਰਾ ਵੀ ਭਾਅ ਜੀ ਇਹ ਸੇਮ ਰੇਟ ਹੀ ਹੈ ਜਿਹੜਾ ਸਲਾਦ ਵਾਲਾ ਹੁੰਦਾ ਇੱਕ ਹੀ ਰੇਟ ਰੱਖਿਆ ਵਾ ਭਾਅ ਜੀ ਸਾਰਾ ਹੀ ਆਪਾਂ ਹਾਂਜੀ ਕੋਈ ਗੱਲ ਨਹੀਂ ਭਾਅ ਜੀ ਕੋਈ ਗੱਲ ਨਹੀਂ ਤੁਸੀਂ ਜਦ ਮਰਜ਼ੀ ਆ ਜਿਓ ਭਾਅ ਜੀ ਤੁਹਾਨੂੰ ਆਪਾਂ ਆਪਣੇ ਵੱਲ ਤੋਂ ਹੋਰ ਡਿਸਕਾਊਂਟ ਦਉਂਗੇ ਜੀ ਕੋਈ ਗੱਲ ਕੋਈ ਗੱਲ ਨਹੀਂ ਭਾਅ ਜੀ ਕੋਈ ਗੱਲ ਨਹੀਂ ਜੀ ਜੇ ਹੋਰ ਵੀ ਹੋਇਆ ਤਾਂ ਭਾਅ ਜੀ ਦੱਸ ਦਿਓ ਜੀ ਓਕੇ ਜੀ ਓਕੇ